ਬਗੀਚੇ ਨੂੰ ਸਮੇਂ ਸਮੇਂ ਦੇ ਉੱਤੇ ਧਿਆਨ ਰੱਖਣਾ ਪੈਂਦਾ ਜੇ ਧਿਆਨ ਨਹੀਂ ਰੱਖਾਂਗੇ ਅਤੇ ਵਿੱਚ ਜਿਵੇਂ ਕਿ ਪੱਕੇ ਹੋਏ ਫ਼ਲ ਡਿੱਗ ਪੈਂਦੇ ਆ ਫੁੱਲ ਡਿੱਗ ਪੈਂਦੇ ਆ ਅਗਰ ਉਹ ਗਲਣਗੇ ਤਾਂ ਉਸ ਤੋਂ ਮੱਛਰ ਪੈਦਾ ਹੋਊਗਾ ਕੀੜੇ ਪੈਦਾ ਹੋਣਗੇ ਜਿਹੜੇ ਕਿ ਆਪਣੇ ਬੂਟਿਆਂ ਨੂੰ ਵੀ ਮੁੜ ਕੇ ਬਾਅਦ 'ਚ ਕੀੜੇ ਜਿਹੜੇ ਉਹ ਤੰਗ ਪ੍ਰੇਸ਼ਾਨ ਹੋਊ ਉੱਥੇ ਜੇ ਉਹਨੂੰ ਨੁਕਸਾਨ ਪਹੁੰਚਾਉਣਗੇ ਕੀੜੇ ਮੱਛਰ ਉਹਨੂੰ ਖਾਊਗਾ ਵਿੱਚ ਘਾਹ ਵਾਧੂ ਘਾਟੂ ਉੱਗਣਾ ਅਤੇ ਹੋਰ ਕੋਈ ਟਾਹਣੀਆਂ ਟੁੱਟੀਆਂ ਸਾਂਭ ਸੰਭਾਲ ਇਹਦੀ ਬਹੁਤ ਜ਼ਰੂਰੀ ਹੈ ਜੇ ਵਿੱਚ ਟਾਹਣੀਆਂ ਟੁੱਟੀਆਂ ਡਿੱਗਣੀਆਂ ਇਹਨੂੰ ਸਮੇਂ ਸਮੇਂ ਦੇ ਉੱਤੇ ਸਾਨੂੰ ਇਹ ਕੱਢਣੀਆਂ ਪੈਣੀਆਂ ਅਤੇ ਜਿਵੇਂ ਕਿ ਕੋਈ ਜ ਫ਼ਲਦਾਰ ਹੁੰਦੇ ਕੋਈ ਫੁੱਲਾਂ ਵਾਲੇ ਹੁੰਦੇ ਕਈਆਂ ਕੰਡੇ ਹੁੰਦੇ ਆ ਅਤੇ ਇੱਕ ਉਹਨੂੰ ਕੋਈ ਸੋਕਾ ਸਾਕਾ ਵੱਜਣ ਦਾ ਡਰ ਹੁੰਦਾ ਸੋ ਇਸੇ ਤਰੀਕੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਉਹਦੇ 'ਚ ਆ ਜਾਂਦੀਆਂ ਜੇ ਸਮੇਂ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ